ਯਾਤਰਾ ਕਰਨ ਦੌਰਾਨ ਕਈ ਤਰ੍ਹਾਂ ਦੀ ਦਿੱਕਤਾਂ ਆਉਂਦੀਆਂ ਨੇ ਜਿਹੜੀ ਛੁੱਟੀਆਂ ਦਾ ਸੀਜ਼ਨ ਹੁੰਦਾ ਹੈ ਉਸ ਵਿੱਚ ਇਹ ਦਿੱਕਤਾਂ ਕਈ ਗੁਣਾਂ ਵੱਧ ਜਾਂਦੀਆਂ ਨੇ ਗਰਮੀ ਦੀਆਂ ਛੁੱਟੀਆਂ ਵਿੱਚ ਜ਼ਿਆਦਾਤਰ ਲੋਕ ਪਹਾੜਾਂ 'ਤੇ ਜਾਂਦੇ ਨੇ ਇੱਦਾਂ ਦੇ ਸੀਜ਼ਨ ਵਿੱਚ ਟਰੈਫਿਕ ਜਾਮ ਇੱਕ ਬਹੁਤ ਬੜੀ ਦਿੱਕਤ ਹੈ ਇਹਦੇ ਇਲਾਵਾ ਮੈਡੀਕਲ ਦੀ ਫੈਸਿਲਟੀ ਦਾ ਨੇੜੇ ਤੇੜੇ ਨਹੀਂ ਹੋਣਾ ਇਹ ਵੀ ਇੱਕ ਮੁੱਖ ਦਿੱਕਤ ਹੈ ਕਈ ਬੰਦੇ ਵੈਜੀਟੇਰੀਅਨ ਹੁੰਦੇ ਨੇ ਉਹਨਾਂ ਨੂੰ ਵੈਜੀਟੇਰੀਅਨ ਰੋਟੀ ਮਿਲਣ ਦਾ ਵੀ ਦਿੱਕਤ ਸਾਹਮਣੇ ਆਉਂਦੀ ਹੈ ਇਹਦੇ ਇਲਾਵਾ ਜਿਹੜੇ ਰੈਸਟ ਰੂਮ ਹੈਗੇ ਹੈ ਉਸ ਵਿੱਚ ਸਾਫ਼ ਸਫ਼ਾਈ ਦਾ ਦਿੱਕਤ ਹੈ